ਹੈਲੋ ਸਤਿ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਵੀ ਕਿੱਦਾਂ ਵਧੀਆ ਵਧੀਆ ਹੋਰ ਪਰਿਵਾਰ ਸਭ ਠੀਕ ਹੋ ਹੋਰ ਸੇਵਾ ਫਿਰ ਬੀਜੀ ਤੂੰ ਆਪ ਰਹਿੰਦਾ ਹੋਣਾ ਕੰਮ ਹੁਣ ਕਿੱਦਾਂ ਕੰਮ ਕਿੱਦਾਂ ਕੰਨਟਕਸ਼ਨ ਦਾ ਲੱਗਾ ਸਿਰੇ ਕਿ ਨਹੀਂ ਅਜੇ ਅੱਛਾ ਅੱਛਾ ਜੀ ਅੱਛਾ ਨਹੀਂ ਸਮਾਨ ਤਾਂ ਰੇਤਾ ਬਜਰੀ ਹੈ ਇਹ ਤਾਂ ਬਥੈਰਾ ਮਿਲ ਜਾਂਦਾ ਅੱਛਾ ਅਤੇ ਸੀਮਿੰਟ

ਅੱਛਾ ਅੱਛਾ ਇਹ ਲੱਗੇ ਹੋਏ ਲੇਬਰ ਫਿਰ ਮਿਲੀ ਜਾਂਦੀ ਹੈ ਅੱਛ ਅੱਛਾ ਸੀਮਿੰਟ ਕਿਹੜਾ ਲਾਇਆ ਹਾਂ ਵਧੀਆ ਵਧੀਆ ਸੀਮਿੰਟ ਵਧੀਆ ਲਾਇਆ ਫਿਰ ਹੈ ਇੱਟ ਫਿਰ ਕੀ ਭਾਅ ਮਿਲੀ ਸੱਤ ਕੁ ਦੇ ਨੇੜੇ ਮੈਂ ਕਹਿੰਦਾ ਸੱਤ ਕੁ ਦੇ ਨੇੜੇ ਵਧੀਆ ਸੱਤ ਹਜ਼ਾਰ ਦੇ ਨੇੜੇ ਤੇੜੇ ਠੀਕ ਹੈ ਠੀਕ ਹੈ ਠੀਕ ਹੈ ਅੱਜ ਫਿਰ ਚੱਲਦਾ ਕੰਮ ਕੁ ਬੰਦ ਠੀਕ ਹੈ ਠੀਕ ਹੈ ਚੱਲੋ ਵਧੀਆ ਛੇਤੀ ਕੰਮ ਨਿਬੇੜ ਕੇ ਵਿਹਲੇ ਹੋ ਆਪਾਂ ਸਿਆਲ ਤੋਂ ਪਹਿਲਾਂ ਪਹਿਲਾਂ ਧੁੰਦਾਂ ਤੋਂ ਠੀਕ ਹੈ ਅਸੀਂ ਫਿਰ ਹੁਣ ਤੁਹਾਡੇ ਬੰਦੇ ਵਿਹਲੇ ਹੋ ਗਏ ਅਸੀਂ ਲਾ ਦੇਣੇ ਫਿਰ ਆਹੀ ਬੰਦੇ ਦੇ ਦਿਓ ਸਾਨੂੰ ਤੁਸੀਂ ਬਸ ਠੀਕ ਹੈ ਉਹ ਹੀ ਬੰਦੇ ਤੁਹਾਡਾ ਤਜਰਬਾ ਅਸੀਂ ਫਿਰ ਕੰਮ ਲੈ ਲੈਣਾ ਓਕ ਓਕੇ ਜੀ ਓਕੇ ਓਕੇ ਓਕੇ ਧੰਨਵਾਦ ਜੀ ਓਕੇ ਜੀ ਓਕੇ ਓਕੇ ਜੀ